ਹਾਂਜੀ ਮੈਂ ਬਠਿੰਡੇ ਤੋਂ ਬਿਲੋਂਗ ਕਰਦਾ ਗਾ ਅਤੇ ਇਸ ਨੂੰ ਮਾਲਵਾ ਏਰੀਆ ਵੀ ਕਿਹਾ ਜਾਂਦਾ ਹੈ ਅਕਸਰ ਇੱਥੇ ਕਾਫੀ ਤਰ੍ਹਾਂ ਦੇ ਪਕ ਪੰਛੀ ਪਾਏ ਜਾਂਦੇ ਆ ਜਿਨ੍ਹਾਂ ਵਿੱਚ ਘੁੱਗੀਆਂ ਗਟਾਰਾਂ ਤੋਤੇ ਮੋਰ ਔਰ ਹੋਰ ਜਿਵੇਂ ਟਟੀਰੀ ਹੋ ਗਈ ਤਿੱਤਰ ਹੋ ਗਏ ਕਾਫੀ ਜ਼ਿਆਦਾ ਪ ਪੰਛੀ ਪਾਏ ਜਾਂਦੇ ਆ ਅਤੇ ਤਿੱਤਰ ਤਿੱਤਰ ਇੱਕ ਬਹੁਤ ਹੀ ਵਧੀਆ ਪੰਛੀ ਹੈ ਜੋ ਕਿ ਕਿਸਾਨਾਂ ਨੂੰ ਵੀ ਇੱਕ ਲਾਹੇਵੰਦ ਪੰਛੀ ਹੈ ਜੋ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਕਰਨ ਵਾਲੀਆਂ ਸੁੰਡੀਆਂ ਨੂੰ ਖਾਂਦਾ ਹੈ ਅਤੇ ਇਹ ਇਸਦੀ ਆਵਾਜ਼ ਵੀ ਕਾਫੀ ਪਿਆਰੀ ਹੁੰਦੀ ਹੈ ਸਵੇਰ ਸਵੇਰ ਦੇ ਟਾਈਮ ਇਹ ਬੋਲਦਾ ਹੈ ਟਟੀਰੀ ਵੀ ਇੱਕ ਵਧੀਆ ਪੰਛੀ ਹੈ ਚੱਕੀ ਰਾਣਾ ਪਹਿਲਾਂ ਹੁੰਦਾ ਸੀ ਇੱਕ ਸੋ ਇਹ ਪੂਰੇ ਅਲੋਪ ਹੁੰਦੇ ਹੋ ਜਾ ਹੋ ਜਾ ਰਹੇ ਹੈ ਅਤੇ ਚਿੜੀਆਂ ਪਹਿਲਾਂ ਐਨਾ ਮਾਹੌਲ ਹੁੰਦਾ ਸੀਗਾ ਪੰਜਾਬ ਦੇ ਵਿੱਚ ਕਿ ਸਾਡੇ ਘਰ ਵਿੱਚ ਤੂਤ ਹੁੰਦਾ ਸੀ ਅਤੇ ਤੂਤ ਦੇ ਉੱਤੇ ਇੱਕ ਦੂਜੇ ਦੀ ਗੱਲ ਨਹੀਂ ਸੁਣਦੀ ਹੁੰਦੀ ਸੀ ਕੋਲ ਕੋਲ ਖੜ੍ਹਿਆਂ ਦੀ ਐਨਾ ਸ਼ੋਰ ਹੁੰਦਾ ਸੀਗਾ ਕਹਿਣ ਦਾ ਮਤਲਬ ਅੱਜ ਦੀ ਅੱਜ ਦੇ ਮਾਹੌਲ ਦੇ ਵਿੱਚ ਦੇਖਿਆ ਜਾਵੇ ਬਿਲਕੁਲ ਅਲੋਪ ਹੁੰਦੇ ਜਾ ਰਹੇ ਆ ਪੰਛੀ ਠੀਕ ਹੈ ਚਿੜੀਆਂ ਤਾਂ ਕੋਈ ਦੇਖਣ ਨੂੰ ਟਾਮ ਟੱਲੀ ਆ ਪਰ ਚਿੜੀਆਂ ਨੂੰ ਦੇਖਣ ਦਾ ਬਹੁਤ ਮਨ ਕਰਦਾ ਹੈਗਾ ਅੱਜ ਦੀ ਘੜੀ ਪਰ ਓਨੀ ਤਾਦਾਦ ਦੇ ਵਿੱਚ ਨਹੀਂ ਹੁੰਦੀ ਕਦੇ ਇੱਕ ਅੱਧੀ ਚਿੜੀ ਦੇਖਣ ਨੂੰ ਮਿਲਦੀ ਆ ਅੱਜ ਦੇ ਟਾਈਮ ਇਸ ਮਾਲਵੇ ਏਰੀਏ ਦੇ ਵਿੱਚ ਅਤੇ ਮੇਰੇ ਦੇਖਣ ਦੇ ਮੁਤਾਬਕ ਇੱਥੇ ਤੋਤਿਆਂ ਦੀ ਗਿਣਤੀ ਅਜੇ ਤਕਰੀਬਨ ਓਨੀ ਹੀ ਹੈ ਅਤੇ ਬਾਕੀ ਗਟਾਰਾਂ ਹੋ ਗਈਆਂ ਕਾਂ ਹੋ ਗਏ ਖੈਰ ਇਹਨਾਂ ਦੀ ਗਿਣਤੀ ਜੋ ਘੱਟ ਗਈ ਹੈ